ਹੈਲੋ ਹਾਂਜੀ ਮੈਂ ਫੂਡ ਵਲੋਗਰ ਗੱਲ ਕਰ ਰਿਹਾਂ ਜੀ ਅਤੇ ਮੈਂ ਨਾ ਅਤੇ ਮੈਂ ਜੀ ਪੰਜਾਬ 'ਚ ਵਿਜਿਟ ਕਰਨਾ ਜੀ ਥੋੜ੍ਹੇ ਟਾਈਮ ਤੱਕ ਥੋੜ੍ਹੇ ਟਾਈਮ ਤੱਕ ਜੀ ਅਤੇ ਫਿਰ ਤੁਸੀਂ ਦੱਸ ਸਕਦੇ ਏ ਵੀ ਇੱਥੇ ਪੰਜਾਬ 'ਚ ਕਿਹੜੀਆਂ ਮਤਲਬ ਮਸ਼ਹੂਰ ਚੀਜ਼ਾਂ ਨੇ ਫੂਡ ਕਿਹੜੇ ਮਸ਼ਹੂਰ ਨੇ ਦੱਸ ਸਕਦੇ ਹੋ ਤੁਸੀਂ ਹਾਂਜੀ ਹਾਂਜੀ ਹਾਂਜੀ ਹਾਂਜੀ ਪਤਾ ਤਾਂ ਮੈਨੂੰ ਹੈ ਤੁ ਤੁਹਾਨੂੰ ਮੈਂ ਐਂ ਪੁੱਛਦਾ ਜੀ ਫੇ ਫੇਮਸ ਫੂਡ ਕਿਹੜਾ ਜੀ ਇੱਥੇ ਪੰਜਾਬ 'ਚ ਜੀ ਮੈਂ ਮੇਰਾ ਯੂਟਿਊਬ 'ਤੇ ਚੈਨਲ ਆ ਜੀ ਟੇਸਟ ਵਿਦ ਅੱਸ ਨਾਲ ਅੱਛਾ ਜੀ ਅੱਛਾ ਜੀ ਅੱਛਾ ਜੀ ਇਸ ਤੋਂ ਇਸ ਤੋਂ ਇਲਾਵਾ ਹੋਰ ਕਿਹੜਾ ਫੂਡ ਆ ਅਤੇ ਡਰਿੰਕ ਹੈ ਜੀ ਅੱਛਾ ਜੀ ਦੇਖੋ ਜੀ ਫੇਮਸ ਫੇਮਸ ਪਲੇਸ ਹੈਗਾ ਕੋਈ ਇੱਥੇ ਖਾਣਾ ਵਧੀਆ ਮਿਲਦਾ ਹੋਵੇ ਅੱਛਾ ਜੀ ਅੱਛਾ ਜੀ ਲੱਸੀ ਬਾਰੇ ਵੀ ਬਹੁਤ ਕੁਝ ਸੁਣਿਆ ਮੈਂ ਇੱਥੇ ਵੀ ਪੰਜਾਬ 'ਚ ਲੱਸੀ ਬਹੁਤ ਵਧੀਆ ਹੁੰਦੀ ਹੈ ਜੀ ਅਤੇ ਇਹਦੇ ਬਾਰੇ ਕੁਝ ਦੱਸ ਸਕਦੇ ਆ ਜੀ ਅੱਛਾ ਜੀ ਸਰ੍ਹੋਂ ਦਾ ਸਾਗ ਵੀ ਬਹੁਤ ਸੁਣਿਆ ਮੱਕੀ ਦੀ ਰੋਟੀ ਸਰ੍ਹੋਂ ਦਾ ਸਾਗ ਇਹਦੇ ਬਾਰੇ ਅੱਛਾ ਜੀ ਅਤੇ ਚਲੋ ਠੀਕ ਹੈ ਜੀ ਫਿਰ ਵੀ ਕਰਦੇ ਹਾਂ ਵਿਜਿਟ ਪੰਜਾਬ 'ਚ ਥੈਂਕ ਯੂ ਓਕੇ